ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਕਿੱਥੋਂ ਬੋਲਦੇ ਹੋ ਅੱਛਾ ਅੱਛਾ ਅੱਛਾ ਅੱਛਾ ਤੁਹਾਨੂੰ ਮੈਂ ਪਹਿਲਾਂ ਥੋੜਾ ਜਿਹਾ ਦੱਸ ਦਿੰਨੀ ਆਪਣੇ ਆਤਮਕਾ ਦਾ ਕੈਂਪ ਬਾਰੇ ਸਾਡਾ ਇਹ ਸਮਰ ਕੈਂਪ ਜੋ ਹੈ ਇਹ ਡੀਏਵੀ ਕਾਲਜ ਦੇ ਲਾਗੇ ਆ ਤੇ ਇੱਥੇ ਅਸੀਂ ਕਾਫੀ ਸਾਰੀਆਂ ਪ੍ਰਕਿਰਿਆ ਬੱਚਿਆਂ ਤੋਂ ਕਰਾਦੇ ਆਂ ਜਿਵੇਂ ਕੀ ਅਸੀਂ ਸਵਿਮਿੰਗ ਸ਼ੁਰੂ ਕੀਤੀ ਹੈ ਬੱਚਿਆਂ ਵਾਸਤੇ ਜੋ ਬਹੁਤ ਹੀ ਵਧੀਆ ਹੁੰਦੇ ਆ ਕਿ ਉਹਨਾਂ ਦੇ ਸਰੀਰ ਨੂੰ ਵੀ ਲਚਕਦਾਰ ਰੱਖਦੀ ਐ ਤੇ ਦੂਸਰੀ ਅਸੀਂ ਸ਼ੁਰੂ ਕੀਤੀ ਹੈ ਐਰੋ ਐਰੋਬੈਟਿਕਸ ਉਹਦੇ ਵਿੱਚ ਅਸੀਂ ਬੱਚਿਆਂ ਐਕਸਰਸਾਈਜ਼ ਕਰਾਦੇ ਆਂ ਜਾਂ ਕੁਝ ਇਦਾਂ ਦੀਆਂ ਗੇਮਾਂ ਖਿਡਾਂਦੇ ਆ ਜਿਨਾਂ ਨਾਲ ਉਹਨਾਂ ਨੂੰ ਮਤਲਵ ਸਰੀਰ ਵਧੀਆ ਰਹਿੰਦਾ ਤੁਸੀਂ ਦੱਸੋ ਤੁਸੀਂ ਆਪਣੇ ਬੱਚੇ ਨੂੰ ਕਿਹੜੇ ਖੇਤਰ ਵਿੱਚ ਲਾਣਾ ਅਸੀਂ ਮਤਲਬ ਵੱਖ ਵੱਖ ਉਮਰ ਦੇ ਬੱਚਿਆਂ ਵਾਸਤੇ ਵੱਖ ਵੱਖ ਖੇਡਾਂ ਨੇ ਜਿਵੇਂ ਕਿ ਜੋ ਛੋਟੇ ਬੱਚੇ ਨੇ ਜਿੱਦਾ ਪੰਜ ਤੋਂ ਦਸ ਸਾਲ ਦੇ ਉਹਨਾਂ ਲਈਆਂ ਜੋ ਖੇਡਾਂ ਉਹ ਹੋਰ ਨੇ ਤੇ ਜਿਹੜੇ ਵੱਡੇ ਨੇ ਉਹਨਾਂ ਲਈ ਵੀ ਖੇਡਾਂ ਹੋਰ ਨੇ ਇਹਦਾ ਅੱਛਾ ਸਰ ਹਾਂਜੀ ਅਸੀਂ ਬੱਚਿਆਂ ਨੂੰ ਕਰਾਟੇ ਸਿਖਾਦੇ ਆ ਤੇ ਬੱਚਿਆਂ ਨੂੰ ਕਾਫੀ ਬੋਕਸਿੰਗ ਦੇ ਬਾਰੇ ਵੀ ਦੱਸਦੇ ਆਂ ਉਹਨਾਂ ਨੂੰ ਪ੍ਰੈਕਟਿਸ ਰੋਜ਼ ਅਭਿਆਸ ਕਰਾਦੇ ਆ ਉਹਨਾਂ ਦਾ ਹਾਂਜੀ ਇਹਦੀ ਫੀਸ ਅਗਰ ਅਸੀਂ ਵੱਖ ਵੱਖ ਖੇਡਾਂ ਦੀ ਜਿੱਦਾਂ ਕਿ ਬਾਕਸਿੰਗ ਦੀ ਲਾਲੋ ਅਸੀ ਇੱਕ ਮਹੀਨੇ ਦੀ ਫੀਸ ਉਹਦੀ ਹੈਗੀ ਆ ਅੱਠ ਹਜਾਰ ਰੁਪਏ ਹਾਂਜੀ ਤੇ ਜਿਹੜੀ ਕਰਾਟੇ ਦੀ ਫੀਸ ਉਹ ਥੋੜੀ ਘੱਟ ਹ ਜਿੱਦਾਂ ਕੀ ਛੇ ਹਜਾਰ ਰੁਪਏ ਹੋਗੇ ਹਾਂਜੀ ਉਹਦੇ ਵਿੱਚ ਅਸੀਂ ਤੁਹਾਨੂੰ ਆਫਰ ਵੀ ਦਿੰਨੇ ਆ ਮਤਲਬ ਦੋ ਤਿੰਨ ਖੇਡਾਂ ਤੁਸੀਂ ਲੈਂਦੇ ਹੋ ਤੇ ਉਹਦੇ ਵਾਸਤੇ ਤੁਹਾਨੂੰ ਆਫਰ ਵੀ ਦਿੰਦੇ ਆ ਜਿਦਾਂ ਕਿ ਪੂਰਾ ਪੈਕਜ ਹੈਗਾ ਪੰਦਰਾਂ ਹਜਾਰ ਦਾ ਤੇ ਤੁਹਾਨੂੰ ਕਿਉਂਕਿ ਨਵੀਂ ਸ਼ੁਰੂਆਤ ਹੋਈ ਹ ਇਸ ਚੀਜ਼ ਕੈਂਪ ਦੀ ਤਾਂ ਤੁਹਾਨੂੰ ਡਿਸਕਾਊਂਟ ਕਰਕੇ ਅਸੀਂ ਦੋ ਹਜਾਰ ਦਾ ਡਿਸਕਾਊਂਟ ਦੇ ਕੇ ਤੁਹਾਨੂੰ ਤੇਰਾਂ ਹਜਾਰ ਤੱਕ ਦਾ ਪੈਜੂਗਾ ਇਹ ਹੈਗਾ ਇੱਕ ਮਹੀਨੇ ਦਾ ਕੋਰਸ ਹੈ ਜੀ ਤੇ ਅਸੀਂ ਪੂਰੀ ਗਰੰਟੀ ਦਿੰਨੇ ਆ ਕਿ ਤੁਹਾਡਾ ਬੱਚਾ ਪੂਰਾ ਸਿੱਖ ਕੇ ਜਾਊਗਾ ਇਥੋਂ ਹਾਂਜੀ ਮਤਲਬ ਜੇ ਤੁਸੀਂ ਸਾਡੇ ਹੋਰ ਮਤਲਬ ਕਲਾਇੰਟ ਵਧਾਉਦੇ ਹੋ ਤਾਂ ਅਸੀਂ ਤੁਹਾਨੂੰ ਹੋਰ ਹਜਾਰ ਰੁਪਇਆ ਹੋਰ ਛੂਟ ਦਿੰਦੇ ਆ ਹਾਂਜੀ ਹਾਂਜੀ ਹਾਂਜੀ ਸਾਡੀ ਟਾਈਮਿੰਗ ਸਾਡੀ ਟਾਈਮਿੰਗ ਹੈਗੀਆਂ ਦੁਪ ਦੁਪਹਿਰ ਬਾਰਾਂ ਵਜੇ ਤੋਂ ਲੈ ਕੇ ਸ਼ਾਮ ਦੇ ਛੇ ਵਜੇ ਤੱਕ ਤੁਸੀਂ ਜਦੋਂ ਮਰਜੀ ਆਜਿਓ ਤੇ ਠੀਕ ਆ ਜੀ ਜਰੂਰ ਜੀ ਜਰੂਰ ਜੀ ਓਕੇ